ਹੈਲੋ ਹਾਂਜੀ ਮੈਮ ਹਾਂਜੀ ਹਾਂਜੀ ਮਿਲ ਜਾਣਗੀਆਂ ਹਾਂਜੀ ਹਾਂਜੀ ਮੈਮ ਅਸੀਂ ਚਾਲ੍ਹੀ ਪਰਸੈਂਟ 'ਤੇ ਬੁੱਕ ਲਵਾਂਗੇ ਅਤੇ ਪੰਜਾਹ ਪਰਸੈਂਟ 'ਤੇ ਅਸੀਂ ਦੇਵਾਂਗੇ ਅਤੇ ਦਸ ਪਰਸੈਂਟ ਦਾ ਤਾਂ ਸਾਨੂੰ ਵੀ ਫਾਇਦਾ ਹੋਣਾ ਚਾਹੀਦਾ ਨਾ ਨਹੀਂ ਨਹੀਂ ਮੈਮ ਇਹ ਤਾਂ ਸਾਡਾ ਬਣਦਾ ਅਸੀਂ ਐਵੇਂ ਹੀ ਕਰਦੇ ਹਾਂ ਪੁਰਾਣੀ ਕਿਤਾਬਾਂ ਚਾਲ੍ਹੀ ਪਰਸੈਂਟ 'ਤੇ ਲੈਂਦੇ ਹਾਂ ਅਤੇ ਨਵੀਂ ਜਿਹੜੀ ਕਿਤਾਬਾਂ ਲੈਣੀਆਂ ਹੁੰਦੀਆਂ ਉਹ ਪੰਜਾਹ ਪਰਸੈਂਟ 'ਤੇ ਦਿੰਦੇ ਆ ਹਾਂਜੀ ਬਿਲਕੁਲ ਨਿਆ ਐਡੀਸ਼ਨ ਹੋਏਗਾ ਅਤੇ ਵਧੀਆ ਹੋਏਗੀ ਕਿਤੇ ਵੀ ਫਟੀ ਨਹੀਂ ਹੋਏਗੀ ਅਤੇ ਵਧੀਆ ਛਪਾਈ ਵਗੈਰਾ ਹੋਏਗੀ ਕਿਤਾਬ 'ਤੇ ਕਿਤੇ ਵੀ ਮਿਸਪ੍ਰਿੰਟ ਨਹੀਂ ਹੋਏਗਾ ਨਹੀਂ ਨਹੀਂ ਜਿਹੜਾ ਤੁਹਾਨੂੰ ਚਾਹੀਦਾ ਅਸੀਂ ਉਹੀ ਬੁੱਕ ਦੇਵਾਂਗੇ ਤੁਹਾਨੂੰ ਨਹੀਂ ਨਹੀਂ ਫੋਰਟੀ ਪਰਸੈਂਟ 'ਤੇ ਹੀ ਮਿਲੇਗੀ ਸਾਡਾ ਫਿਕਸ ਆ ਨਹੀਂ ਨਹੀਂ ਇਹ ਤਾਂ ਸਾਡਾ ਫਿਕਸ ਹੈ ਤੁਸੀਂ ਕੋਈ ਨਹੀਂ ਜਿੰਨੀ ਮਰਜ਼ੀ ਕਿਤਾਬਾਂ ਲਿਆ ਜੇ ਵਧੀਆ ਹੋਏਗੀ ਕੁਆਲਿਟੀ ਵੀ ਵਧੀਆ ਹੋਏਗੀ ਅਤੇ ਛਪਾਈ ਵੀ ਵਧੀਆ ਹੋਏਗੀ ਫਟੀ ਨਹੀਂ ਹੋਏਗੀ ਕਿਤੇ ਵੀ ਹਾਂਜੀ ਸਾਰੀਆਂ ਬੁੱਕਸ ਦਾ ਇੱਕ ਜਿਹਾ ਪ੍ਰਾਈਜ ਆ ਹਾਂਜੀ ਤੁਸੀਂ ਵੇਖ ਲਿਆ ਜੇ ਤੁਸੀਂ ਲੈਣੀ ਹੋਵੇ ਤਾਂ ਨਹੀਂ ਪਰ ਵੈਸੇ ਸਾਡੇ ਕੋਲ ਹਰ ਤਰ੍ਹਾਂ ਦੀ ਬੁੱਕ ਹੈ ਤੁਸੀਂ ਜਿਓਗ੍ਰਫੀ ਲੈਣੀ ਹੈ ਹਿਸਟਰੀ ਲੈਣੀ ਹੈ ਹਰ ਤਰ੍ਹਾਂ ਦੀ ਜਿਵੇਂ ਤੁਹਾਨੂੰ ਚਾਹੀਦੀ ਹੈ ਤੁਹਾਨੂੰ ਉਹ ਵੀ ਕਿਤਾਬਾਂ ਮਿਲਣਗੀ ਬਸ ਚਾਲ੍ਹੀ ਪਰਸੈਂਟ 'ਤੇ ਅਸੀਂ ਲਵਾਂਗੇ ਜੇ ਤੁਸੀਂ ਪੁਰਾਣੀਆਂ ਕਿਤਾਬਾਂ ਲੈਣੀਆਂ ਨੇ ਤਾਂ ਅਸੀਂ ਚਾਲ੍ਹੀ ਪਰਸੈਂਟ 'ਤੇ ਲੈ ਕੇ ਪੰਜਾਹ ਪਰਸੈਂਟ 'ਤੇ ਤੁਹਾਨੂੰ ਦੇਵਾਂਗੇ ਵੈਸੇ ਹਾਂਜੀ ਪਰ ਬਾਕੀ ਦੁਕਾਨਦਾਰ ਦਾ ਜਿਵੇਂ ਵੀ ਕਰਦੇ ਨੇ ਪਰ ਸਾਡਾ ਫਿਕਸ ਆ ਠੀਕ ਆ ਮੈਮ ਵੇਖ ਲਿਓ ਜੇ ਤੁਸੀਂ ਠੀਕ ਹੈ ਮੈਮ